ਹੈਲੋ ਹਾਂਜੀ ਅਮਨ ਮੈਮ ਗੁੱਡ ਆਫਟਰਨੂਨ ਠੀਕ ਹੈ ਮੈਮ ਤੁਸੀਂ ਦੱਸੋ ਕੀ ਹਾਲ ਚਾਲ ਹਾਂਜੀ ਹਾਂਜੀ ਹਾਂਜੀ ਚਲੋ ਆਲਮੋਸਟ ਹੁਣ ਆਪਾਂ ਫਰੀ ਹਾਂ ਇਗਜ਼ਾਮ ਤੁਹਾਡੇ ਪੇਪਰ ਹੋ ਗਏ ਮੈਮ ਚੈਕ ਸਾਰੇ ਅੱਛਾ ਜੀ ਅੱਛਾ ਮੈਮ ਤੁਹਾਨੂੰ ਵੀ ਕੁਛ ਥੋੜ੍ਹਾ ਇਸ਼ੂ ਆਇਆ ਬੱਚਿਆਂ ਦੇ ਪੇਪਰ ਨੂੰ ਲੈ ਕੇ ਕੁਝ ਤੁਸੀਂ ਅੱਗੇ ਸੋਚਿਆ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਹੈਂਡਲ ਕਰੀਏ ਜਿਹਨਾਂ ਬੱਚਿਆਂ ਦਾ ਥੋੜ੍ਹਾ ਰਿਜਲਟ ਇਸ ਵਾਰੀ ਖਰਾਬ ਗਿਆ ਹਾਂਜੀ ਐਕਚੁਲੀ ਮੈਂ ਵੀ ਇਹੀ ਚੀਜ਼ ਸੋਚ ਰਹੀ ਸੀ ਕਿ ਇਹਨਾਂ ਬੱਚਿਆਂ ਨੂੰ ਨਾ ਕੁਝ ਸਪੈਸ਼ਲ ਕਲਾਸਿਸ ਦਿੱਤੀਆਂ ਜਾਣ ਅਲੱਗ ਬਾਕੀ ਬੱਚਿਆਂ ਤੋਂ ਕਿਉਂਕਿ ਦੇਖੋ ਜਿਹੜੇ ਪੜ੍ਹਨ ਵਾਲੇ ਬੱਚੇ ਆ ਉਹ ਤਾਂ ਆਪਾਂ ਨੋਰਮਲ ਵੀ ਅਗਰ ਕਲਾਸ ਦੇ ਵਿੱਚ ਕਰਾਉਂਦੇ ਹਾਂ ਨਾ ਉਹਨਾਂ ਨੂੰ ਇੱਕ ਟਾਈਮ ਹੀ ਦੱਸਣਾ ਪੈਂਦਾ ਅਤੇ ਉਹ ਸਾਰਾ ਹੈਂਡਲ ਕਰ ਲੈਂਦੇ ਆ ਸਮਝ ਲੈਂਦੇ ਆ ਸਾਰਾ ਬਟ ਇਹ ਬੱਚੇ ਕੁਝ ਧਿਆਨ ਨਹੀਂ ਦਿੰਦੇ ਜਾਂ ਕਹਿ ਲਓ ਕਿ ਛੁੱਟੀਆਂ ਬਹੁਤ ਕਰਦੇ ਆ ਇਹ ਵੀ ਇਹਨਾਂ ਦਾ ਇੱਕ ਵੀਕ ਪੁਆਇੰਟ ਹੈ ਕਮਜ਼ੋਰੀ ਬਣ ਜਾਂਦੀ ਹੈ ਪੜ੍ਹਾਈ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਕੁਝ ਵਾਰਨਿੰਗਸ ਵੀ ਦਿੱਤੀਆਂ ਜਾਣ ਕੁਝ ਹਿਦਾਇਤਾਂ ਇੱਦਾਂ ਦੀਆਂ ਦਿੱਤੀਆਂ ਜਾਣ ਕਿ ਇਹਨਾਂ ਨੂੰ ਸਟ੍ਰਿਕਟਲੀ ਕੁਝ ਕਾਨੂੰਨ ਬਣਾਏ ਜਾਣ ਇਹਨਾਂ ਲਈ ਸਕੂਲ ਦੇ ਨਿਯਮਾਂ ਦੇ ਅਕੋਰਡਿੰਗ ਕਿ ਇੱਕ ਤਾਂ ਛੁੱਟੀ ਨਹੀਂ ਕਰਨਗੇ ਦੂਜੀ ਗੱਲ ਹੈ ਇਹਨਾਂ ਦੀਆਂ ਆਪਾਂ ਐਕਸਟਰਾ ਕਲਾਸਿਸ ਲਈਏ ਤਾਂ ਜੋ ਇਹਨਾਂ ਦਾ ਅੱਗੇ ਰਿਜ਼ਲਟ ਵਧੀਆ ਆਏ ਹਾਂਜੀ ਹਾਂਜੀ ਠੀਕ ਹਾਂਜੀ ਕੋਈ ਨਹੀਂ ਫਿਰ ਆਪਾਂ ਅਗਲੇ ਸਮੈਸਟਰ ਦੀ ਜੋ ਤਿਆਰੀ ਕਰਦੇ ਹਾਂ ਤਾਂ ਆਪਾਂ ਇਸ ਬਾਰੇ ਡਿਸਕਸ ਇੱਕ ਵਾਰ ਮਿਲ ਕੇ ਜ਼ਰੂਰ ਕਰਾਂਗੇ ਮੈਡਮ ਠੀਕ ਹੈ ਹਾਂ ਹਾਂਜੀ ਹਾਂਜੀ ਠੀਕ ਹੈ ਮੈਮ ਕੱਲ੍ਹ ਮਿਲਦੇ ਹਾਂ ਜੀ ਬਾਏ